ਅੱਜ ਦੇ ਸਮੇਂ ਵਿੱਚ ਲੋਕਾਂ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਇਸ ਦੇ ਨਾਲ ਹੀ ਸਿਲਾਈ ਬੁਣਾਈ ਦੇ ਖੇਤਰ ਵਿੱਚ ਵੀ ਬਹੁਤ ਜਿਆਦਾ ਤਰੱਕੀ ਹੋਈ ਹੈ ਸਾਨੂੰ ਬਹੁਤ ਸਾਰੀਆਂ ਤਕਨੀਕਾਂ ਨਵੀਆਂ ਦੇਖਣ ਨੂੰ ਮਿਲਦੀਆਂ ਹਨ ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਮਸ਼ੀਨਾਂ ਆ ਗਈਆਂ ਹਨ ਜਿਹਨਾਂ ਨਾਲ ਕੱਪੜਾ ਸਿਉਣਾ ਬਹੁਤ ਜ਼ਿਆਦਾ ਆਸਾਨ ਹੋ ਚੁੱਕਿਆ ਹੈ

ਮਤਲਬ ਬਹੁਤ ਸਾਰੀਆਂ ਤਰੀ ਬਹੁਤ ਸਾਰੀਆਂ ਤਕਨੀਕਾਂ ਦੇ ਕੱਪੜੇ ਸਾਨੂੰ ਅੱਜ ਦੇਖਣ ਨੂੰ ਮਿਲਦੇ ਹਨ ਅਤੇ ਜੋ ਰਿਵਾਇਤੀ ਕੱਪੜੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੋਟਨ ਜਾਂ ਰੇਸ਼ਮ ਦਾ ਕੱਪੜਾ ਹੀ ਯੂਸ ਕੀਤਾ ਜਾਂਦਾ ਹੈ ਅਤੇ ਇਹਨਾਂ ਕੱਪੜਿਆਂ ਨੂੰ ਯੂਸ ਕਰਕੇ ਹੀ ਉਹਨਾਂ 'ਤੇ ਕਢਾਈ ਕਰਕੇ ਅੱਗੇ ਵੇਚਿਆ ਜਾਂਦਾ ਹੈ